ਹੈਲੋ ਮੇਰਾ ਨਾਂ ਛਾਇਆ ਹੈ ਤੁਸੀਂ ਜਗਦੀਪ ਸਿੰਘ ਬੋਲ ਰਹੇ ਹੋ ਸਰ ਮੈਂ ਉਬਰ ਐਪ ਤੋਂ ਤੁਹਾਡੀ ਕੈਬ ਬੁੱਕ ਕੀਤੀ ਸੀਗੀ ਅਤੇ ਉਹਦੇ ਵਿੱਚ ਮੈਨੂੰ ਦੱਸਿਆ ਗਿਆ ਸੀ ਕੀ ਕਿ ਤੁਹਾਡੀ ਜਿਹੜੀ ਕੈਬ ਹੈ ਉਹ ਮੇਰੇ ਤੱਕ ਪੰਜ ਮਿੰਟ ਦੇ ਵਿੱਚ ਪਹੁੰਚ ਜਾਵੇਗੀ ਅਤੇ ਮੈਂ ਪਿਛਲੇ ਵੀਹ ਮਿੰਟ ਤੋਂ ਖੜ੍ਹੀ ਤੁਹਾਡੀ ਉਡੀਕ ਕਰਨੀ ਹਾਂ ਅਤੇ ਤੁਸੀਂ ਅਜੇ ਤੱਕ ਆਏ ਨਹੀਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਐਗਜ਼ੈਕਟ ਇਸ ਸਮੇਂ ਕਿੱਥੇ ਹੋ ਅਤੇ ਤੁਹਾਨੂੰ ਮੇਰੇ ਕੋਲ ਪਹੁੰਚਣ ਲਈ ਕਿੰਨਾ ਕੁ ਟਾਈਮ ਲੱਗੂ ਹਾਂਜੀ ਓਕੇ ਤੁਸੀਂ ਦੁੱਖ ਨਿਵਾਰਨ ਸਾਹਿਬ ਹੋ ਅਤੇ ਤੁਹਾਨੂੰ ਲੀਲਾ ਭਵਨ ਪਹੁੰਚਣ ਦੇ ਵਿੱਚ ਪੰਜ ਮਿੰਟ ਲੱਗਣਗੇ ਦੇਖੋ ਸਰ ਮੈਨੂੰ ਇਸ ਸਮੇਂ ਛੇਤੀ ਆ ਅਤੇ ਮੈਂ ਛੇਤੀ ਜਾਣਾ ਕਿਤੇ ਜੇਕਰ ਤੁਸੀਂ ਪੰਜ ਮਿੰਟ ਦੇ ਵਿੱਚ ਪਹੁੰਚ ਸਕਦੇ ਹੋ ਤਾਂ ਤਾਂ ਠੀਕ ਹੈ ਜੇਕਰ ਤੁਸੀਂ ਮੇਰੇ ਕੋਲ ਨਹੀਂ ਪਹੁੰਚ ਸਕਦੇ ਪਲੀਜ਼ ਮੈਨੂੰ ਦੱਸ ਦਿਉ ਤਾਂ ਕਿ ਮੈਂ ਕੈਬ ਕੈਂਸਲ ਕਰ ਦੇਵਾਂ ਅਤੇ ਆਪਣੀ ਕੋਈ ਹੋਰ ਸਾਧਨ ਲੱਭ ਕੇ ਮੈਂ ਕਿਤੇ ਹੋਰ ਚਲੀ ਜਾਵਾਂ ਹਾਂਜੀ ਓਕੇ ਸਰ ਮੈਂ ਪੰਜ ਮਿੰਟ ਤੱਕ ਵੇਟ ਕਰਦੀ ਹਾਂ ਜੇ ਤੁਸੀਂ ਨਹੀਂ ਆਉਂਗੇ ਜਾਂ ਫਿਰ ਤੁਸੀਂ ਨਹੀਂ ਵੀ ਆ ਸਕਦੇ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਦੇਵੋ ਤਾਂ ਕਿ ਮੈਂ ਇਹ ਰਾਈਡ ਕੈਂਸਲ ਕਰ ਦੇਵਾਂ ਅਤੇ ਆਪਣਾ ਕੋਈ ਹੋਰ ਸਾਧਨ ਲੱਭ ਸਕਾਂ ਥੈੱਕ ਯੂ ਸਰ